ਮੇਰੀਆਂ ਮਨਪਸੰਦ ਬਾਈਕਸ ਜੋ ਹਨ ਉਹ ਆ ਟਰੈਕਡ ਮੈਨ ਐਸ ਐਲ ਆਰ ਨਾਈਨ ਸਟੇਟ ਬਾਈਕਸਾਈਕਲ ਫੋਰ ਥਰੀ ਵਨ ਜ਼ੀਰੋ ਡੈਂਗੋ ਕਮਿਊਨਿਟ ਮੋਡਲ ਯੇਤੀ ਐੱਸ ਬੀ ਆਈ ਵਨ ਥਰੀ ਜ਼ੀਰੋ ਮਾਊਂਟੇਨ ਬਾਈਕ ਔਰ ਰੋਕ ਰਾਈਡ ਅਤੇ ਇਹਨਾਂ ਵਿੱਚੋਂ ਜੋ ਹੈ ਕਿ ਜਿਸ ਜੋ ਬਾਈਕ ਮੇਰੇ ਕੋਲ ਇਸ ਸਮੇਂ ਹੈ ਉਸ ਬਾਈਕ ਦਾ ਨਾਮ ਹੈ ਡੈਂਗੋ ਕਮਿਊਨਿਟ ਮੋਡਲ ਅਤੇ ਜਿਹੜੀ ਮੇਰੀ ਡਰੀਮ ਬਾਈਕ ਹੈ ਉਹਦਾ ਨਾਮ ਟਰੈਕਡ ਮੈਨ ਐੱਸ ਐੱਲ ਆਰ ਹੈ ਕਿਉਂਕਿ ਉਹ ਬਹੁਤ ਹੀ ਲਾਈਟ ਵੇਟ ਹੈ ਅਤੇ ਉਹ ਬਹੁਤ ਹੀ ਸਮੂਲੀ ਚੱਲਦੀ ਆ ਜੋ ਕਿ ਮਾਊਂਟੇਨ ਵਾਲੀ ਸਾਈਡ ਹੈ ਜਿੱਥੇ ਬਹੁਤ ਹੀ ਜ਼ਿਆਦਾ ਰੈਫਨੈਸ ਹੁੰਦੀ ਹੈ ਉਬੜ ਖਾਬੜ ਜੋ ਰਸਤਾ ਹੁੰਦਾ ਹੈ ਜੀ ਹੈ ਨਾ ਸਮੂਥ ਰਸਤਾ ਨਹੀਂ ਹੁੰਦਾ ਉੱਥੇ ਇਹ ਬਹੁਤ ਹੀ ਆਰਾਮ ਨਾਲ ਅਤੇ ਬਹੁਤ ਵਧੀਆ ਤਰੀਕੇ ਨਾਲ ਚੱਲਦੀ ਹੈ ਅਤੇ ਇਹ ਇੱਕ ਤਾਂ ਇੱਕ ਹੋਰ ਵੀ ਇਹਦਾ ਫੀਚਰ ਹੈ ਕਿ ਜਿਵੇਂ ਇਹ ਇਲੈਕਟ੍ਰਿਕ ਬਾਈਕ ਹੈ ਅਤੇ ਜ ਜਿਸ ਨਾਲ ਇਹ ਬਹੁਤ ਹੈਲਪਫੁੱਲ ਹੁੰਦੀ ਹੈ ਆਰਾਮ ਨਾਲ ਆਰਾਮ ਨਾਲ ਚਲਾਈ ਜਾ ਸਕਦੀ ਹੈ ਅਤੇ ਦੇਖਣ ਵਿੱਚ ਬਿਲਕੁਲ ਵੀ ਇਸ ਤਰ੍ਹਾਂ ਨਹੀਂ ਲੱਗਦੀ ਕਿ ਇਲੈਕਟ੍ਰਿਕ ਬਾਈਕ ਹੈ ਔਰ ਜੋ ਬਾਈਕਿੰਗ ਲਈ ਜੋ ਬਹੁਤ ਹੀ ਆਰਾਮਦਾਇਕ ਬਾਈਕਸ ਨੇ ਉਹ ਉਹਨਾਂ ਵਿੱਚੋਂ ਇੱਕ ਇਹ ਹੈ ਯੇਤੀ ਯੇਤੀ ਔਰ ਦੂਸਰੀ ਹੈ ਰਾਈਡ ਬਾਈਕ ਰੋਕ ਰਾਈਡਰ ਇਹ ਦੋਨੋਂ ਹੀ ਜਿਹੜੀਆਂ ਬਾਈਕਸ ਨੇ ਉਹ ਬਹੁਤ ਹੀ ਜਿਹੜੀਆਂ ਯਾਤਰਾਵਾਂ ਲਈ ਆਰਾਮਦਾਇਕ ਹਨ ਥੈਂਕ ਯੂ